ਪੰਜਾਬ ਵਿੱਚ ਬਹੁਤ ਹੀ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਕਾਲਜ ਹਨ ਜਿਹਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਜੋ ਅੰਮ੍ਰਿਤਸਰ ਵਿੱਚ ਕਾਲਜ ਹਨ ਉਹ ਹਨ ਖਾਲਸਾ ਕੋਲੇਜ ਖਾਲਸਾ ਕੋਲੇਜ ਅੋਫ ਵੂਮੈਂਨ ਖਾਲਸਾ ਕੋਲੇਜ ਅੋਫ ਇੰਜੀਨੀਅਰ ਔਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਆਈ ਆਈ ਐਮ ਆਈ ਐਮ ਆਈ ਆਈ ਐਮ ਅੰਮ੍ਰਿਤਸਰ ਆਈ ਆਈ ਟੀ ਰੁ ਰੋਪੜ ਅਤੇ ਆਈ ਆਈ ਟੀ ਅਤੇ ਜਿਹਨਾਂ ਵਿੱਚ ਸਾਨੂੰ ਅਲੱਗ ਅਲੱਗ ਤਰ੍ਹਾਂ ਦੇ ਕੋਰਸ ਅਤੇ ਡਿਗਰੀਆਂ ਮਿਲ ਜਾਂਦੀਆਂ ਹਨ ਅਤੇ ਇਹਨਾਂ ਵਿੱਚ ਜੋ ਸਭ ਤੋਂ ਵੱਧ ਜੋ ਇਸ ਸਮੇਂ ਦੇ ਵਿੱਚ ਬੱਚੇ ਲੈ ਰਹੇ ਹਨ ਜੋ ਪ੍ਰਸਿੱਧ ਕੋਰਸ ਹਨ ਉਹ ਹਨ ਬੀਟੈਕ ਬੀਟੈਕ ਬੀਟੈਕ ਸੀ ਐੱਸ ਈ ਬੀਟੈਕ ਇੰਜੀਨੀਅਰਿੰਗ ਬੀਟੈਕ ਸਿਵਲ ਇੰਜੀਨੀਅਰਿੰਗ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਐਮ ਬੀ ਬੀ ਐਸ ਬੀ ਸੀ ਏ ਅਤੇ ਪੀ ਐਚ ਡੀ ਇਨ ਏ ਪੀ ਐਚ ਡੀ ਇਨ ਇੰਗਲਿਸ਼ ਪੀ ਐਚ ਡੀ ਇਨ ਪੰਜਾਬੀ ਅਤੇ ਹੋਰ ਵੀ ਉੱਚ ਪ੍ਰਕਾਰ ਦੀਆਂ ਵਿੱਦਿਆਵਾਂ ਸਾਨੂੰ ਕੋਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਮਿਲ ਰਹੀਆਂ ਹਨ ਅਤੇ ਸਾਨੂੰ ਬਾਹਰਲੇ ਜੋ ਦੂਰ ਵੱਡੇ ਟੈਸਟਾਂ ਨੂੰ ਪਾਸ ਕਰਨ ਵਾਸਤੇ ਵੀ ਸਾਨੂੰ ਕੋਲਜਾਂ ਵਿੱਚ ਹੀ ਸਿੱਖਿਆ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਯੂ ਪੀ ਐੱਸ ਸੀ ਜੋ ਇੱਕ ਸਭ ਤੋਂ ਪ੍ਰਸਿੱਧ ਟੈਸਟ ਹੈ ਇੱਥੋਂ ਦਾ ਕਿਸੇ ਵੀ ਆਈ ਪੀ ਐਸ ਜਿਸ ਨੇ ਆਈ ਪੀ ਐਸ ਬਣਨਾ ਹੈ ਉਸ ਲਈ ਜ਼ਰੂਰੀ ਹੈ ਉਹਦੀ ਸਿੱਖਿਆ ਵੀ ਸਕੂਲਾਂ ਕਾਲਜਾਂ ਵਿੱਚ ਅਤੇ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਦਿੱਤੀ ਜਾਂਦੀ ਹੈ ਅਤੇ ਅਸੀਂ ਇਨ ਹੋਰ ਵੀ ਬਹੁਤ ਸਾਰੇ ਕੋਲਜ ਅਤੇ ਯੂਨੀਵਰਸਿਟੀਆਂ ਹਨ ਇੱਥੇ ਪੰਜ ਜਿਸ ਤਰ੍ਹਾਂ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਹੈ ਬਹੁ ਅਤੇ ਸਾਨੂੰ ਅਲੱਗ ਅਲੱਗ ਬਹੁਤ ਸਾਰੇ ਉੱਥੇ ਉਚ ਅਤੇ ਪ੍ਰਮੁੱਖ ਯੂਨੀਵਰਸਿਟੀਆਂ ਪੰਜਾਬ ਵਿੱਚ ਮਿਲ ਜਾਂਦੀਆਂ ਹਨ